ਸੁਨੀਲ ਟੂਰ ਐਡ ਟਰੈਵਲ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਕੋਲ ਇੱਕ ਕੈਬ ਬੁਕ ਕੀਤੀ ਸੀ ਅਤੇ ਮੇਰੀ ਟਰੇਨ ਦਾ ਟਾਈਮ ਦਸ ਵਜੇ ਸੀ ਤੁਹਾਡੀ ਕੈਬ ਵਾਲਾ ਡਰਾਈਵਰ ਮੇਰੇ ਕੋਲ ਸਮੇਂ ਸਿਰ 'ਤੇ ਨਹੀਂ ਪਹੁੰਚਿਆ ਸਮੇਂ ਸਿਰ ਨਾ ਪਹੁੰਚਣ ਕਾਰਨ ਮੇਰੀ ਟਰੇਨ ਮਿਸ ਹੋ ਗਈ ਹੈ ਅਤੇ ਮਿਸ ਹੋਣ ਕਾਰਨ ਮੇਰਾ ਬਹੁਤ ਬੜਾ ਨੁਕਸਾਨ ਹੋ ਗਿਆ ਮੇਰਾ ਬਹੁਤ ਵੱਡਾ ਨੁਕਸਾਨ ਹੋਣ ਕਾਰਨ ਮੈਂ ਤੁਹਾਨੂੰ ਕੈਬ ਦਾ ਕੋਈ ਚਾਰਜਸ ਨਹੀਂ ਕਰਾਂਗਾ ਕਿਉਂਕਿ ਤੁਹਾਡੀ ਸਰਵਿਸ ਠੀਕ ਨਹੀਂ ਸੀ ਜਿਸ ਕਾਰਨ ਮੇਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਹਾਡੀ ਸਰਵਿਸ ਨਾ ਹੋਣ ਕਾਰਨ ਮੇਰੀ ਟਰੇਨ ਮੇਰੇ ਹੱਥੋਂ ਛੁੱਟ ਹੱਥੋਂ ਛੁੱਟ ਗਈ ਆ ਜਿਸ ਕਾਰਨ ਮੇਰੀ ਅਰਜੈਂਟ ਮੀਟਿੰਗ ਸੀ ਜਿਸ ਵਿੱਚ ਮੈਂ ਨਹੀਂ ਪਹੁੰਚ ਸਕਿਆ ਨਾ ਪਹੁੰਚਣ ਕਾਰਨ ਮੈਂ ਤੁਹਾਡਾ ਕੋਈ ਵੀ ਪੈਸਾ ਪ੍ਰੋਵਾਈਡ ਨਹੀਂ ਕਰਾਂਗਾ